ਮੋਬਾਇਲ ਗੇਮਿੰਗ ਦੇ ਉਭਾਰ ਨੇ ਸਮੁੱਚੇ ਮੋਬਾਈਲ ਉਦਯੋਗ ਨੂੰ ਕਾਫ਼ੀ ਹੱਲਾਸ਼ੇਰੀ ਦਿੱਤੀ ਹੈ ਮੋਬਾਇਲਾਂ ਦਾ ਉਦਯੋਗ ਕਾਫ਼ੀ ਵੱਧ ਫੁੱਲ ਰਿਹਾ ਹੈ ਕਿਉਂਕੀ ਪਹਿਲਾਂ ਜਿੱਥੇ ਘਰ ਵਿੱਚ ਇੱਕ ਫੋਨ ਹੋਣਾ ਲਾਜ਼ਮੀ ਹੁੰਦਾ ਸੀ ਹੁਣ ਘਰ ਵਿੱਚ ਜਿੰਨੇ ਜੀਅ ਨੇ ਉੰਨੇ ਹੀ ਮੋਬਾਈਲ ਹੁੰਦੇ ਨੇ ਔਰ ਹਰ ਮੋਬਾਇਲ ਵਿੱਚ ਨੈਟ ਜਿਹੜਾ ਉਹ ਪਾਇਆ ਹੁੰਦਾ ਬੱਚਿਆਂ ਨੂੰ ਖੇਡਣ ਲਈ ਮੋਬਾਈਲ ਚਾਹੀਦਾ ਵਪਾਰੀ ਨੂੰ ਆਪਣੇ ਵਪਾਰਕ ਸੌਦੇਬਾਜ਼ੀ ਗੱਲਾਂ ਕਰਨ ਲਈ ਫੋਨ ਚਾਹੀਦਾ ਘਰ ਦੀ ਔਰਤ ਨੂੰ ਡਰਾਮੇ ਵੇਖਣ ਲਈ ਵੀ ਫੋਨ ਹੀ ਚਾਹੀਦਾ ਅੱਜ ਕੱਲ੍ਹ ਅਤੇ ਕੁਝ ਜਿਹੜੇ ਜਿਸ ਤਰ੍ਹਾਂ ਹੁਣ ਸਿਲੰਡਰ ਬੁੱਕ ਕਰਵਾਉਣਾ ਉਹਦੇ ਲਈ ਵੀ ਫੋਨ ਹੀ ਚਾਹੀਦਾ ਹੁਣ ਫੋਨ ਜਿਹੜਾ ਵਾ ਉਹ ਇੱਕ ਸਾਡੇ ਲਈ ਅਨਿੱਖੜਵਾਂ ਹੋ ਗਿਆ ਸਾਡਾ ਜ਼ਰੂਰੀ ਹੋ ਗਿਆ ਜ਼ਰੂਰਤ ਹੀ ਬਣ ਗਿਆ ਪਹਿਲਾਂ ਇਹ ਇੱਕ ਲਗਜ਼ਰੀ ਆਈਟਮ ਸੀਗੀ ਹੁਣ ਇਹ ਸਾਡੀ ਜ਼ਰੂਰਤ ਹੀ ਬਣ ਗਿਆ ਇਹ ਤੋਂ ਬਿਨਾਂ ਆਪਾਂ ਨੂੰ ਲੱਗਦਾ ਕਿ ਜਿਵੇਂ ਜੀਵਨ ਸੰਭਵ ਹੀ ਨਹੀਂ ਹੈ ਕੋਈ ਕੰਮ ਹੀ ਸੰਭਵ ਨਹੀਂ ਹੈ ਤੋ ਕਿਸੇ ਨਾਲ ਦੂਰ ਦੁਰਾਡੇ ਗੱਲ ਕਰਨੀ ਹੈ ਉਹਦੇ ਲਈ ਸਾਨੂੰ ਹੋਰ ਨੈੱਟ ਪੈਕ ਚਾਹੀਦੇ ਆ ਅਤੇ ਇਹਨੇ ਮੋਬਾਇਲ ਉਦਯੋਗ ਤਾਂ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਲੱਗਦਾ ਕਿ ਕਾਫ਼ੀ ਵਧੇਗਾ ਅਤੇ ਜੇ ਇਹਦੇ ਵਿੱਚ ਸਾਡੇ ਬੱਚੇ ਕੋਈ ਆਪਣੀ ਇੰਡਸਟਰੀ ਬਣਾਉਣ ਮੋਬਾਈਲ ਉਦਯੋਗ 'ਚ ਤਾਂ ਹੋਰ ਵੀ ਵਧੀਆ ਗੱਲ ਹੈ ਆ ਕਿਉਂਕੀ ਇਸ ਕਿੱਤੇ ਨੇ ਵਧਣਾ ਹੀ ਵਧਣਾ ਹੈ ਇਹ ਹੈ ਪੀ ਪਰ ਨਵੀਂ ਹਰ ਮਹੀਨੇ ਹ ਜਿਹੜੀ ਹੈ ਨਵਾਂ ਵਰਜ਼ਨ ਜਦੋਂ ਕਿਸੇ ਫੋਨ ਦਾ ਆਉਂਦਾ ਉਹਦੇ 'ਚ ਟੈਕਨੋਲਜੀ ਨਵੀਂ ਨਵੀਨੀਕਰਨ ਕਿੰਨਾ ਬਹੁਤ ਜ਼ਿਆਦਾ ਮਤਲਬ ਫਟਾਫਟ ਚੇਂਜ ਹੋ ਰਿਹਾ ਸਾਰਾ ਸਿਸਟਮ ਇਹ ਨਹੀਂ ਵੀ ਇੱਕ ਚੀਜ਼ ਲਈ ਆ ਤਾਂ ਉਹ ਪਤਾ ਨਹੀਂ ਸਾਰੀ ਉਮਰ ਹੀ ਉਹਦੇ ਨਾਲ ਲੰਘ ਜਾਣੀ ਨਵੀਂ ਨਵੀਂ ਟੈਕਨੋਲਜੀ ਆਉਣ ਡਈ ਹੈ ਨਵੀਂ ਸੋਚ ਆਉਣ ਡਈ ਹੈ ਨਵੀਂ ਫੈਸਿਲਟੀਜ ਆਉਣ ਡਈਆਂ ਸੋ ਇਹ ਇੱਕ ਬਹੁਤ ਹੀ ਵਧੀਆ ਉਦਯੋਗ ਹੈਗਾ ਇਹਦੇ 'ਚ ਆਉਣਾ ਚਾਹੀਦਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਵੀ ਇਸ ਉਦਯੋਗ ਵੱਲ ਨੂੰ ਆਉਣਾ ਚਾਹੀਦਾ